ਗਾਣੇ ਤਾਂ ਜਿਵੇਂ ਮਤਲਬ ਜ਼ਿਆਦਾਤਰ ਸਾਰੇ ਹੀ ਵਧੀਆ ਹੀ ਹੁੰਦੇ ਨੇ ਲੋਕ ਇੰਨੀ ਮਿਹਨਤ ਨਾਲ ਬਣਾਉਂਦੇ ਨੇ ਜਿੰਨੇ ਵੀ ਸਿੰਗਰ ਨੇ ਗਾਉਂਦੇ ਨੇ ਮਿਹਨਤ ਨਾਲ ਨੇ ਪਰ ਮੈਨੂੰ ਜਿਹੜਾ ਸਾਰਿਆਂ ਨਾਲੋਂ ਵਧੀਆ ਲੱਗਦਾ ਉਹ ਸਤਿੰਦਰ ਸਰਤਾਜ ਦੇ ਗਾਣੇ ਬ ਬਹੁਤ ਵਧੀਆ ਲੱਗਦੇ ਨੇ ਅਤੇ ਉਹ ਗਾਣਿਆਂ 'ਚ ਮਤਲਬ ਇੱਕ ਮਤਲਬ ਹੁੰਦਾ ਇੱਕ ਅਲੱਗ ਜਿਹੀ ਚੀਜ਼ ਹੁੰਦੀ ਆ ਵੀ ਉਹਨੂੰ ਸੁਣ ਕੇ ਇੱਕ ਰੂਹ ਨੂੰ ਸਕੂਨ ਮਿਲਦਾ ਏ ਵੀ ਹਾਂ ਬਾਕਈ ਕਿਸੇ ਨੇ ਕੁਛ ਗਾਇਆ ਅਤੇ ਨਹੀਂ ਤਾਂ ਬਾਕੀ ਤਾਂ ਜ਼ਿਆਦਾਤਰ ਤਾਂ ਦੂਏ ਲੋਟ ਏ ਚੱਲਦਾ ਏ ਵੀ ਚੱਕ ਲਓ ਧਰ ਲਓ ਏ ਚਲਦਾ ਨਹੀਂ ਤਾਂ ਅਤੇ ਇਹਦੇ ਗਾਣੇ ਮੈਨੂੰ ਬਾਕਈ ਬਹੁਤ ਸੋਹਣੇ ਲੱਗਦੇ ਨੇ ਅਤੇ ਉਹਨਾਂ 'ਚ ਮਤਲਬ ਹੁੰਦਾ ਹਰੇਕ ਲਾਈਨ ਦਾ ਕੋਈ ਨਾ ਕੋਈ ਮਤਲਬ ਹੁੰਦਾ ਅਤੇ ਉਹ ਸ਼ਬਦ ਜਿਹੜੇ ਲੈ ਕੇ ਆਉਂਦਾ ਏ ਸ਼ਬਦ ਇੰਨੇ ਕੁ ਡੂੰਘੇ ਲੈ ਕੇ ਆਉਂਦਾ ਵੀ ਵੀ ਪੜ੍ਹੇ ਤੋਂ ਬਿਨਾਂ ਸ਼ਾਇਦ ਕਿਤਾਬਾਂ ਤੋਂ ਬਿਨਾਂ ਕਿਤਾਬਾਂ ਦੇ ਗਿਆਨ ਤੋਂ ਬਿਨਾਂ ਉਹ ਸ਼ਬਦ ਮੈਂ ਕਹਿੰਦਾ ਲੱਭਣੇ ਅਤੇ ਸਮਝਣੇ ਬਹੁਤ ਔਖੀ ਗੱਲ ਆ ਅਤੇ ਉਹਨਾਂ ਦੇ ਮਤਲਬ ਨੂੰ ਸਮਝਣਾ ਅਤੇ ਬਿਨਾਂ ਮਤਲਬ ਕਿਤਾਬਾਂ ਦੇ ਗਿਆਨ ਤੋਂ ਜਾਂ ਪੜ੍ਹੇ ਤੋਂ ਬਿਨਾਂ ਜਿਹੜੀ ਚੀਜ਼ ਨੂੰ ਉਹਨੇ ਲਿਖਿਆ ਏ ਉਹਨੂੰ ਪੜ੍ਹੇ ਤੋਂ ਬਿਨਾਂ ਅਤੇ ਉਹਦਾ ਮਤਲਬ ਹਰੇਕ ਬੰਦਾ ਨਹੀਂ ਸਮਝ ਸਕਦਾ ਅਤੇ ਹਰੇਕ ਬੰਦੇ ਨੂੰ ਮਤਲਬ ਸਮਝਣ ਦੀ ਉਹ ਚੀਜ਼ 'ਚ ਵੜਨਾ ਪੈਂਦਾ ਉਹ ਚੀਜ਼ 'ਚ ਮਤਲਬ ਉਹਨੂੰ ਪੜ੍ਹਨਾ ਪੈਂਦਾ ਏ ਅਤੇ ਮੈਨੂੰ ਸ ਸਤਿੰਦਰ ਸਰਤਾਜ ਦੇ ਗਾਣੇ ਬਹੁਤ ਵਧੀਆ ਲੱਗਦੇ ਨੇ